ਸਤਿ ਸ਼੍ਰੀ ਅਕਾਲ ਭਾਅ ਜੀ ਤੁਸੀਂ ਓਪੋ ਸ਼ੋਅਰੂਮ ਤੋਂ ਬੋਲਦੇ ਨੇ ਮੈਂ ਤੁਹਾਡੀ ਦੁਕਾਨ ਤੋਂ ਇੱਕ ਫ਼ੋਨ ਔਰਡਰ ਕੀਤਾ ਸੀ ਜਦੋਂ ਕੀ ਮੈਂ ਜਦੋਂ ਤੁਹਾਡਾ ਡਿਲੀਵਰੀ ਬੁਆਏ ਮੈਨੂੰ ਦੇਣ ਆਇਆ ਸੀ ਤਾਂ ਉਸਨੇ ਮੇਰੇ ਤੋ ਇਸਦੇ ਅਲੱਗ ਤੋਂ ਚਾਰਜਿਸ ਲਏ ਸੀ ਜਦੋਂ ਕੀ ਤੁਸੀਂ ਕਹਿੰਦੇ ਸੀ ਕੀ ਇਸ ਦੇ ਕੋਈ ਚਾਰਜਿਸ ਨਹੀਂ ਹੈ ਇਹ ਤੁਹਾਨੂੰ ਫ੍ਰੀ ਆਫ਼ ਕੋਸਟ ਹੋਣਗੇ ਜਦੋਂ ਮੈਂ ਇਸਦੀ ਪੈਕਿੰਗ ਖੋਲ੍ਹੀ ਤਾਂ ਇਸਦੀ ਪੈਕਿੰਗ ਵੀ ਖ਼ਰਾਬ ਸੀ ਇਸ ਦਾ ਮੈਨੂੰ ਕਲਰ ਵੀ ਪਸੰਦ ਨਹੀਂ ਆਇਆ ਜਦੋਂ ਮੈਂ ਇਸ ਫ਼ੋਨ ਨੂੰ ਯੂਜ਼ ਕੀਤਾ ਤਾਂ ਇਸਦੇ ਕੈਮਰਾ ਕੁਆਲਿਟੀ ਵੀ ਬਿਲਕੁਲ ਹੀ ਖ਼ਰਾਬ ਹੈ ਜਦੋਂ ਮੈਂ ਇਸਦੀਆਂ ਫੋਟੋਆਂ ਖਿੱਚੀਆਂ ਤਾਂ ਇਸਦੀਆਂ ਫੋਟੋਆਂ ਸਾਫ਼ ਨਹੀਂ ਆਈਆਂ ਅਤੇ ਬਾਕੀ ਜਦੋਂ ਇਸਦਾ ਮੈਂ ਇਸਨੂੰ ਹੋਰ ਯੂਜ਼ ਕੀਤਾ ਵਰਤੋਂ ਵਿੱਚ ਲਿਆਂਦਾ ਇਸਨੂੰ ਨਾ ਤਾਂ ਇਸਦਾ ਬੈਟਰੀ ਬੈਕਅੱਪ ਸਹੀ ਹੈ ਇਸਦਾ ਬੈਟਰੀ ਬੈਕਅੱਪ ਟੈਮ ਨਹੀਂ ਕੱਢਦਾ ਅਤੇ ਇਸਦੇ ਨਾਲ਼ ਨਾ ਤਾਂ ਮੈਨੂੰ ਹੈਡਫੋਨ ਮਿਲੇ ਨੇ ਅਤੇ ਨਾ ਹੀ ਚਾਰਜਰ ਮਿਲੇ ਨੇ ਜੋ ਕੀ ਮੈਨੂੰ ਤੁਹਾਡਾ ਇਹ ਪ੍ਰੋਡਕਟ ਪਸੰਦ ਨਹੀਂ ਆਇਆ ਮੈਂ ਇਸ ਨੂੰ ਵਾਪਸ ਭੇਜ ਰਿਹਾ ਹਾਂ